ਹਾਂਜੀ ਇੱਕ ਨਵੇਂ ਜਨਮੇ ਬੱਚਿਆਂ ਨੂੰ ਸਵੱਛ ਵਾਤਾਵਰਨ ਦੀ ਬਹੁਤ ਲੋੜ ਹੁੰਦੀ ਹੈ ਤਾਂ ਕਿ ਬੱਚੇ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਚਾਹੀਦਾ ਅਤੇ ਆਪਣਾ ਮੱਛਰਾਂ ਤੋਂ ਸਪਰੇਅ ਕਰਕੇ ਰੱਖਣੀ ਚਾਹੀਦੀ ਹੈ ਕਮਰੇ ਖੁੱਲ੍ਹੇ ਹਵਾਦਾਰ ਹੋਣੇ ਚਾਹੀਦੇ ਹੈ ਤਾਂ ਕਿ ਬੱਚੇ ਨੂੰ ਤਾਜ਼ੀ ਹਵਾ ਆਵੇ ਅਤੇ ਆਪਾਂ ਨੂੰ ਮੱਖੀ ਮੱਛਰ ਤੋਂ ਬਚਾਅ ਕੇ ਰੱਖਣਾ ਅਤੇ ਰੋਜ਼ ਡਟੋਲ ਦਾ ਪੋਚਾ ਲਾਉਣਾ ਚਾਹੀਦਾ ਬੱਚੇ ਨੂੰ ਪਿੱਤ ਤੋਂ ਬਚਾਅ ਕੇ ਰੱਖਣਾ ਚਾਹੀਦਾ ਬੱਚੇ ਨੂੰ ਟਾਈਮ ਸਿਰ ਨਵਾਉਣਾ ਉਸਨੂੰ ਟਾਈਮ ਟਾਈਮ 'ਤੇ ਦੁੱਧ ਦੇਣਾ ਚਾਹੀਦਾ ਹੱਥ ਸਾਫ ਕਰਕੇ ਮਾਂ ਨੂੰ ਬੱਚੇ ਨੂੰ ਹਮੇਸ਼ਾ ਚੱਕਣਾ ਚਾਹੀਦਾ ਅਤੇ ਗਰਮੀ ਸਰਦੀ ਵਿੱਚ ਐਵੇਂ ਆ ਵੀ ਬੱਚੇ ਨੂੰ ਠੰਡੇ ਹੱਥਾਂ ਨਾਲ ਨਹੀਂ ਚੱਕਣਾ ਜੇ ਮਾਂ ਠੰ ਠੰਡ ਵਿੱਚ ਕੰਮ ਕਰਦੀ ਹੈ ਅਤੇ ਜੱਕਦਮ ਦਾ ਬੱਚੇ ਨੂੰ ਦੁੱਧ ਨਹੀਂ ਦੇਣਾ ਅਤੇ ਗਰਮੀ ਦੇ ਵਿੱਚ ਬੱਚੇ ਨੂੰ ਹਮੇਸ਼ਾ ਆਪਣਾ ਜੇ ਮਾਂ ਕੰਮ ਕਰਦੀ ਹੈ ਤਾਂ ਉਸ ਨੂੰ ਆਪਣਾ ਆਪਣੇ ਆਪ ਨੂੰ ਥੋੜ੍ਹਾ ਜਿਹਾ ਸ ਸਰੀਰ ਨੂੰ ਠੰਡਾ ਕਰਕੇ ਫਿਰ ਦੁੱਧ ਪਿਉਣਾ ਤਾਂ ਕਿ ਇੱਕਦਮ ਗਰਮ ਗਰਮ ਦੁੱਧ ਪਿਆਇਆ ਅਤੇ ਬੱਚੇ ਨੂੰ ਗਰਮੀ ਹੋਣ ਦਾ ਡਰ ਹੁੰਦਾ ਹੈ ਅਤੇ ਇਸ ਤਰ੍ਹਾਂ ਸਰਦੀ ਵਿੱਚ ਬੱਚੇ ਨੂੰ ਅਸੀਂ ਜੇ ਸਰਦੀ ਹੈ ਤਾਂ ਸਰਦੀ ਵਿੱਚ ਬੱਚੇ ਨੂੰ ਵੱਧ ਤੋਂ ਵੱਧ ਅਸੀਂ ਢੱਕ ਕੇ ਰੱਖਣਾ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਬਹੁਤ ਜ਼ਿਆਦਾ ਠੰਡ ਹੈ ਤਾਂ ਉਸ ਵਿੱਚ ਹੀਟਰ ਵੀ ਲਾ ਕੇ ਬੱਚੇ ਨੂੰ ਹੀਟ ਦੇ ਸਕਦੇ ਹਾਂ ਬੱਚੇ ਨੂੰ ਗਿੱਲਾ ਨਹੀਂ ਰੱਖਣਾ ਉਸਨੂੰ ਟਾਈਮ ਟਾਈਮ 'ਤੇ ਡਾਈਪਰ ਬਦਲਣਾ ਟਾਈਮ 'ਤੇ ਦੁੱਧ ਦੇਣਾ ਅਤੇ ਹਮੇਸ਼ਾ ਹੀ ਮੂੰਹ ਨਾਲ ਮੂੰਹ ਨਹੀਂ ਬੱਚੇ ਨੂੰ ਜ਼ਿਆਦਾ ਲਾਉਣਾ ਚਾਹੀਦਾ ਜੇ ਮਾਂ ਬਿਮਾਰ ਹੋਵੇ ਤਾਂ ਉਸਨੂੰ ਆਪਣੇ ਬੱਚੇ ਨੂੰ ਬੱਚੇ ਨੂੰ ਦੁੱਧ ਨਹੀਂ ਦੇਣਾ ਚਾਹੀਦਾ ਅਤੇ ਮਾਂ ਨੂੰ ਹੈਵੀ ਖਾਣ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਜ਼ਿਆਦਾ ਬਹੁਤ ਜ਼ਿਆਦਾ ਤਲਿਆ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਸਾਨੂੰ ਮਾਂ ਨੂੰ ਆ ਜਿੰਨਾ ਆਪਣਾ ਬਚਾਅ ਰੱਖੇਗੀ ਓਨਾ ਹੀ ਸਾਡਾ ਬੱਚਾ ਸ ਬੱਚਾ ਤੰਦਰੁਸਤ ਰਹੇਗਾ ਅਤੇ ਜਿੰਨਾ ਵਾਤਾਵਰਨ ਸਾਫ ਹੋਵੇਗਾ ਅਤੇ ਅਸੀਂ ਬਿਮਾਰੀ ਤੋਂ ਮੱਖੀ ਮੱਛਰ ਤੋਂ ਬਚੇ ਰਹਾਂਗੇ ਇਸ ਤਰ੍ਹਾਂ ਸਾਨੂੰ ਇਹ ਗੱਲਾਂ ਦਾ ਬਹੁਤ ਬਹੁਤ ਧਿਆਨ ਰੱਖਣਾ ਚਾਹੀਦਾ ਧੰਨਵਾਦ ਜੀ